ਮੈਂ ਜਦੋਂ ਕੁਝ ਕੁ ਸਮਾਂ ਅਧਿਆਪਨ ਦੇ ਖੇਤਰ ਦੇ ਵਿੱਚ ਕੰਮ ਕੀਤਾ ਤਾਂ ਉਦੋਂ ਮੇਰੇ ਕਲੀਗਸ ਦੇ ਰੂਪ ਦੇ ਵਿੱਚ ਇੱਕ ਵੀਰ ਸੀ ਜਿਸਦੇ ਨਾਲ ਮਿਲਣਾ ਗੱਲਬਾਤ ਕਰਨਾ ਕੁਝ ਹੱਦ ਤੱਕ ਮੈਨੂੰ ਮੁਸ਼ਕਲ ਲੱਗਦਾ ਸੀਗਾ ਜਾਂ ਉਹਦੇ ਮਨ ਦੇ ਵਿੱਚ ਮੇਰੇ ਪ੍ਰਤੀ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਸੀਗੀਆਂ ਜਾਂ ਮੇਰੇ ਪ੍ਰਤੀ ਉਹਦੇ ਮਨ ਦੇ ਵਿੱਚ ਧਾਰਨਾਵਾਂ ਬਣੀਆਂ ਹੋਈਆਂ ਸੀਗੀਆਂ ਭਾਵੇਂ ਤਾਂ ਉਹ ਨਿਰਮੂਲ ਸਨ ਕੋਈ ਉਹਨਾਂ ਦਾ ਆਧਾਰ ਨਹੀਂ ਸੀਗੇ ਪਰ ਫਿਰ ਵੀ ਉਸ ਵੇਲੇ ਜਾਂ ਉਹ ਸਥਿਤੀ ਦੇ ਵਿੱਚ ਸਾਨੂੰ ਉਹ ਬੜੀਆਂ ਅਹਿਮ ਅਤੇ ਬੜੀਆਂ ਵੱਡੀਆਂ ਲੱਗਦੀਆਂ ਸਨ ਜਿਨ੍ਹਾਂ ਕਰਕੇ ਆਪਸੀ ਤਾਲਮੇਲ ਦੇ ਨਾਲ ਕੰਮ ਕਰਨਾ ਸਾਡੇ ਲਈ ਬੜਾ ਮੁਸ਼ਕਲ ਸੀ ਪਰ ਫਿਰ ਵੀ ਉਸ ਸਥਿਤੀ ਨੂੰ ਉਹਨਾਂ ਪ੍ਰਸਥਿਤੀਆਂ ਨੂੰ ਨਜਿੱਠਣ ਦੇ ਲਈ ਕੁਝ ਹੱਦ ਤੱਕਰ ਕੰਮ ਇਵੇਂ ਕਰਨਾ ਪਿਆ ਕਿ ਕੁਝ ਚੀਜ਼ਾਂ ਨੂੰ ਅਣਗੋਲਿਆ ਕਰਨਾ ਪਿਆ ਇਗਨੋਰ ਕਰਨਾ ਪਿਆ ਅਣਗੋਲਿਆ ਕਰਕੇ ਉਸ ਸਥਿਤੀ ਨੂੰ ਸੁਲਝਾਉਣ ਦਾ ਯਤਨ ਕੀਤਾ ਲੋੜ ਅਨੁਸਾਰ ਨਿਵ ਕੇ ਚੱਲਣਾ ਪਿਆ ਬਿਨਾਂ ਕਿਸੇ ਗੱਲ ਤੋਂ ਬਹਿਸ ਜਾਂ ਝਗੜਾ ਕਰਨ ਤੋਂ ਕਾਫੀ ਹੱਦ ਤੱਕਰ ਗੁਰੇਜ਼ ਕੀਤਾ ਗਿਆ ਕਿ ਨਹੀਂ ਕਿਸੇ ਤਰੀਕੇ ਨਾਲ ਵੀ ਇਹ ਸਾਡੇ ਜਿਹੜੀ ਇੱਕ ਖਿੱਚੋਤਾਣ ਉਹ ਜ਼ਿਆਦਾ ਵੱਡੀ ਨਾ ਹੋਵੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਘੱਟ ਕਰ ਸਕੀਏ ਫਿਰ ਉਸ ਸਥਿਤੀ ਨੂੰ ਸੁਲਝਾਉਣ ਦੇ ਲਈ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਵਿਚਰਿਆ ਗਿਆ ਇਸ ਤਰੀਕੇ ਨਾਲ ਵਿਚਰਨ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਵੀ ਕਿਸੇ ਤਰੀਕੇ ਦੇ ਨਾਲ ਬੁਰਾ ਨਾ ਲੱਗੇ ਅਤੇ ਇਹ ਜਿਹੜਾ ਸਾਡਾ ਉਹ ਸਮਾਂ ਸੀਗਾ ਉਹ ਪਰਿਸਥਿਤੀ ਸੀਗੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸੁਲਝ ਗਈ